ਸਾਡੇ ਘਰ ਦੇ ਬਾਗ ਕੋਲ ਅਤੇ ਉਸਦੇ ਆਸ ਪਾਸ ਬਹੁਤ ਸਾਰੇ ਦਰੱਖਤ ਲੱਗੇ ਹੋਏ ਹਨ ਉਹਨਾਂ 'ਤੇ ਗੱਤੇ ਦੇ ਬਣਾਏ ਆਲ੍ਹਣੇ ਰੱਖੇ ਗਏ ਹਨ ਉਹਨਾਂ ਨੂੰ ਅਲੱਗ ਅਲੱਗ ਤਰ੍ਹਾਂ ਸਜਾਇਆ ਗਿਆ ਹੈ ਤਾਂ ਜੋ ਕਿ ਪੰਛੀਆਂ ਨੂੰ ਆਕਰਸ਼ਿਤ ਕੀਤਾ ਜਾ ਸਕੇ ਇਸ ਦੇ ਨਾਲ ਹੀ ਉੱਥੇ ਪੇਪਰ ਦੀਆਂ ਕੋਲੀਆਂ ਬਣਾ ਕੇ ਉਹਨਾਂ ਵਿੱਚ ਅਨਾਜ ਭਰ ਕੇ ਰੱਖਿਆ ਗਿਆ ਹੈ ਤਾਂ ਜੋ ਪੰਛੀ ਉੱਥੇ ਆਪਣਾ ਭੋਜਨ ਕਰ ਸਕਣ ਅਤੇ ਆਪਣੇ ਬੱਚਿਆਂ ਨੂੰ ਵੀ ਭੋਜਨ ਦੇ ਸਕਣ ਮਿੱਟੀ ਦੇ ਵੱਡੀਆਂ ਕੋਲੀਆਂ ਬਣਾ ਕੇ ਉਸ ਵਿੱਚ ਨੂੰ ਸਜਾਵਟ ਕਰਕੇ ਉਸ ਵਿੱਚ ਪਾਣੀ ਭਰ ਕੇ ਰੱਖਿਆ ਗਿਆ ਹੈ ਤਾਂ ਜੋ ਗਰਮੀ ਦੇ ਮੌਸਮ ਦੇ ਵਿੱਚ ਪੰਛੀਆਂ ਨੂੰ ਪਾਣੀ ਦੀ ਭਾਲ ਲਈ ਅਤੇ ਅਨਾਜ ਦੀ ਭਾਲ ਦੇ ਲਈ ਦੂਰ ਦੁਰਾਡੇ ਨਾ ਜਾਣਾ ਪਵੇ